ਹਾਂਜੀ ਪੰਜਾਬ ਦੇ ਕਾਰੋਬਾਰਾਂ ਅਤੇ ਪ੍ਰਵਾਸ ਮਾਈਗ੍ਰੇਸ਼ਨ ਦਾ ਬਹੁਤ ਹੀ ਬੁਰਾ ਪ੍ਰਭਾਵ ਪੈ ਰਿਹਾ ਹੈ ਕਿਉਂਕਿ ਸਾਡੇ ਇੱਥੇ ਦੇ ਨੌਜਵਾਨ ਬੱਚੇ ਆਪਣੇ ਪੰਜਾਬ ਨੂੰ ਛੱਡ ਕੇ ਜ਼ਿਆਦਾਤਰ ਬਾਹਰ ਬਾਹਰਲੇ ਦੇਸ਼ਾਂ ਵਿੱਚ ਜਾ ਕੇ ਕਾਰੋਬਾਰ ਕਰ ਰਹੇ ਆ ਕਿਉਂਕਿ ਇੱਧਰ ਸਰਕਾਰ ਵੀ ਨੌਕਰੀਆਂ ਨਹੀਂ ਦੇ ਰਹੀ ਜਿਸ ਨਾਲ ਬੱਚੇ ਬੱਚਿਆਂ ਦਾ ਰੁਝਾਨ ਜਿਹੜਾ ਬਾਹਰਲੇ ਕਾਰੋਬਾਰਾਂ ਦੇ ਵਿੱਚ ਜਾ ਕੇ ਕੰਮ ਕਰਨ 'ਤੇ ਜ਼ਿਆਦਾ ਵੱਧ ਰਿਹਾ ਆ ਪੰਜਾਬ ਦੇ ਜਿਹੜੇ ਉਹਨਾਂ ਨੂੰ ਵੀ ਚਾਹੀਦਾ ਕਿ ਆਪਣੇ ਪੰਜਾਬ ਦੇ ਕਾਰੋਬਾਰਾਂ ਨੂੰ ਅੱਗੇ ਵਧਾਉਣ ਪੰਜਾਬ ਦੇ ਵਿੱਚ ਰਹਿ ਕੇ ਕੰਮ ਕਰਨ ਤਾਂ ਜੋ ਸਾਡੇ ਪੰਜਾਬ ਦੀ ਤਰੱਕੀ ਹੋ ਸਕੇ ਸਾਡਾ ਪੰਜਾਬ ਇੱਕ ਖੁਸ਼ਹਾਲ ਬਣ ਸਕੇ ਤਾਂ ਜੋ ਇੱਥੇ ਹੀ ਵੱਧ ਤੋਂ ਵੱਧ ਸਾਡੇ ਕਾਰੋਬਾਰਾਂ ਨੂੰ ਵਧਾਉਣਾ ਚਾਹੀਦਾ ਹੈ ਪਰ ਜਿਹੜੇ ਸਾਡੇ ਅੱਜ ਕੱਲ੍ਹ ਦੇ ਬੱਚੇ ਆ ਉਹ ਜ਼ਿਆਦਾਤਰ ਬਾਹਰ ਪੰਜਾਬ ਨੂੰ ਛੱਡ ਕੇ ਬਾਹਰਲੇ ਹੋਰ ਦੇਸ਼ਾਂ ਦੇ ਵਿੱਚ ਬਾਹਰ ਜਾ ਕੇ ਕੰਮ ਕਰ ਰਹੇ ਆ ਉਹਨਾਂ ਨਾਲ ਉਹਨਾਂ ਦੇ ਦੇਸ਼ ਦੀ ਤਰੱਕੀ ਹੋਰ ਦੇਸ਼ਾਂ ਦੀ ਤਰੱਕੀ ਹੋਈ ਜਾਂਦੀ ਹੈ ਅਤੇ ਆਪਣੇ ਪੰਜਾਬ ਜਿਹੜਾ ਪਿੱਛੇ ਜਾਈ ਜਾ ਰਿਹਾ ਜਦੋਂ ਕਿ ਸਾਨੂੰ ਆਪਣੀ ਪੰਜਾਬੀ ਅਤੇ ਪੰਜਾਬ ਨੂੰ ਵਧੀਆ ਬਣਾਉਣ ਦੇ ਲਈ ਸਾਨੂੰ ਇੱਧਰ ਹੀ ਕਾਰੋਬਾਰ ਕਰਨਾ ਚਾਹੀਦਾ ਹੈ ਆਪਣੇ ਬੱਚਿਆਂ ਨੂੰ ਵੀ ਇਹੀ ਦੱਸਣਾ ਚਾਹੀਦਾ ਕਿ ਆਪਣੇ ਇੱਧਰ ਪੰਜਾਬ ਦੇ ਵਿੱਚ ਹੀ ਰਹਿ ਕੇ ਅੱਗੇ ਬਿਜਨਸ ਕੋਈ ਵੀ ਕਾਰੋਬਾਰ ਇੱਧਰ ਹੀ ਕਰਨ ਤਾਂ ਜੋ ਸਾਡੇ ਪੰਜਾਬ ਦੇ ਵਿੱਚ ਵਧੀਆ ਟੈਕਨੋਲੋਜੀ ਅਗਾਂਹ ਤੋਂ ਅਗਾਂਹ ਵਧੀਆ ਇਹ ਵੱਧ ਸਕੇ ਅਤੇ ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਆਪਣੇ ਪੰਜਾਬ ਦੇ ਬੱਚਿਆਂ ਨੂੰ ਵਧੀਆ ਨੌਕਰੀਆਂ ਹਿਸਾਬ ਨਾਲ ਦਿੱਤੀਆਂ ਜਾਣ ਤਾਂ ਜੋ ਬੱਚਿਆਂ ਦਾ ਬਾਹਰ ਜਾਣ ਦਾ ਰੁਝਾਨ ਜਿਹੜਾ ਉਹ ਘੱਟ ਜਾਵੇ ਅਤੇ ਬੱਚੇ ਇੱਧਰ ਹੀ ਜ਼ਿਆਦਾ ਕੰਮ ਕਰਨ ਧੰਨਵਾਦ